ਪੰਜਾਬੀ ਬਹੁਤ ਪੁਰਾਣੇ ਭਾਸ਼ਾ ਨਾ ਜੋ ਗੁਰੂਆਂ ਪੀਰਾਂ ਦੇ ਜਿਉ ਚੱਲਣੇ ਚੱਲੇ ਆ ਰਹੀ ਆ ਅਤੇ ਅਤੇ ਹੁਣ ਮਤਲਬ ਕਿ ਪਹਿਲਾਂ ਸਾਰੇ ਪੰਜਾਬੀ ਬੋਲਦੇ ਹੁੰਦੇ ਸੀਗੇ ਹੈ ਨਾ ਅਤੇ ਉਸ ਤੋਂ ਬਾਅਦ ਮਤਲਬ ਕੁਝ ਗੋਰਿਆਂ ਨੇ ਹੈ ਨਾ ਇੱਥੇ ਰਾਜ ਕੀਤਾ ਅਤੇ ਬਾਹਰ ਦੇ ਲੋਕ ਵੀ ਹੈ ਨਾ ਇੱਥੇ ਆਉਣ ਲੱਗ ਗਏ ਜਿਹਨਾਂ ਕਰਕੇ ਲੋਕ ਇੰਗਲਿਸ਼ ਸਿੱਖ ਗਏ ਹਿੰਦੀ ਸਿੱਖ ਗਏ ਅਤੇ ਹਿੰਦੀ ਵਗੈਰਾ ਬੋਲਣ ਲੱਗ ਗਏ ਅਤੇ ਇਸ ਤੋਂ ਬਾਅਦ ਜਿੱਦਾਂ ਹੁਣ ਕਈ ਪਹਿਲਾਂ ਪੰਜਾਬ ਜਿਹੜੇ ਬੱਚੇ ਨੂੰ ਪਾਉਂਦੇ ਹੁੰਦੇ ਸੀਗੇ ਪੰਜਾਬੀ ਸਕੂਲ 'ਚ ਪਾਉਂਦੇ ਹੁੰਦੇ ਸੀਗੇ ਬਟ ਹ ਪਰ ਹੁਣ ਜਿਹੜੇ ਹੈਗੇ ਆ ਉਹ ਸਾਰੇ ਮਤਲਬ ਕਿ ਇ ਇੰਗਲਿਸ਼ ਸਕੂਲ 'ਚ ਆ ਫਿਰ ਪ੍ਰਾਈਵੇਟ ਸਕੂਲ 'ਚ ਪਾਉਂਦੇ ਆ ਕਿ ਜਿਹਦੇ ਕਰਕੇ ਵੇ ਹੈ ਨਾ ਵੀ ਹੁਣ ਦੇ ਹੁਣ ਦੇ ਟਾਈਮ ਦੇ ਵਿੱਚ ਇਹ ਸੋਚਦੇ ਆ ਕਿ ਹਾਂ ਵੀ ਇੰਗਲਿਸ਼ ਆਉਣੀ ਚਾਹੀਦੀ ਆ ਪੰਜਾਬੀ ਨਹੀਂ ਆਉਣੀ ਚਾਹੀਦੀ ਇਸ ਕਰਕੇ ਸਾਰੀ ਤਬਦੀਲੀਆਂ ਆਈਆਂ ਹੈ ਨਾ ਅਤੇ ਇਸ ਤੋਂ ਬਾਅਦ ਜਿਹੜਾ ਉਹ ਹੈ ਮੈਂ ਮਤਲਬ ਮੈਂ ਆਪਣੇ ਪੰਜਾਬੀ ਸਕੂਲ 'ਚ ਪੜ੍ਹੀ ਹਾਂ ਅਤੇ ਮੇਰੇ ਜਿਹੜੇ ਫਰੈਂਡਸ ਆ ਉਹਨਾਂ ਨੂੰ ਪੰਜਾਬੀ ਵਗੈਰਾ ਹੀ ਆਉਂਦੀ ਆ ਅਤੇ ਮੈਨੂੰ ਤਾਂ ਲੱਗਦਾ ਕਿ ਜਿਹੜੀ ਪੰਜਾਬੀ ਭਾਸ਼ਾ ਉਹ ਜ਼ਿਆਦਾ ਵਧੀਆ ਕਿਉਂਕਿ ਉਹਦੇ ਵਿੱਚ ਰਿਸਪੈਕਟ ਵਗੈਰਾ ਹੁੰਦੀ ਹੈ ਨਾ ਮਤਲਬ ਇੱਕ ਇੱਕ ਪਰਸਨ ਅਤੇ ਦੂਜੇ ਰਿਸਪੈਕਟ ਨਾਲ ਗੱਲ ਕਰਦਾ ਆ ਅਤੇ ਜਿਹੜੀ ਪੰਜਾਬੀ ਭਾਸ਼ਾ ਆ ਉਹਨੂੰ ਮਤਲਬ ਉਹ ਇਸ ਤਰੀਕੇ ਨਾਲ ਤਬਦੀਲੀਆਂ ਕਿਉਂਕਿ ਬਾਹਰ ਦੇ ਲੋਕ ਜਿਹੜੇ ਵਗੈਰਾ ਨਾ ਉਹ ਇੱਥੇ ਆ ਕੇ ਰਹਿਣ ਲੱਗ ਗਏ ਜਿਹਦੇ ਕਰਕੇ ਇੰਗਲਿਸ਼ ਵਗੈਰਾ ਸਿੱਖ ਲਈ ਆ